ਹਾਂਜੀ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ

ਹਾਂਜੀ ਹਾਂਜੀ ਘਰੇ ਪਚਾ ਦਵਾਂਗੇ ਸਬਜ਼ੀਆਂ ਸਬਜ਼ੀ ਜੀ ਅੱਜ ਕੱਲ੍ਹ ਪਿਆਜ ਜਿਹੜੇ ਹੈ ਚਾਲ਼ੀ ਰੁਪਏ ਕਿਲੋ ਹੈ ਆਲੂ ਵੀਹ ਰੁਪਏ ਹੈ ਗੋਭੀ ਸਾਡੇ ਪੰਜਾਹ ਰੁਪਏ ਕਿਲੋ ਚੱਲ ਰਹੀਂ ਹੈ ਘਰ ਦੀ ਹੈ ਤਾਜ਼ੀ ਹੈ ਇੱਕਦਮ ਹਾਂਜੀ ਹਾਂਜੀ ਸਾਡੇ ਆਪਣੇ ਹੀ ਖੇਤ ਹੈ ਜੀ ਹਾਂਜੀ ਹਾਂਜੀ ਹਾਂਜੀ ਕੋਈ ਨੀ ਤੁਸੀਂ ਮੈਨੂੰ ਨਾ ਹਾਂਜੀ ਇਸੇ ਨੂੰ ਸਾਡੀ ਦੁਕਾਨ ਜੀ ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਦੇ ਸਾਢੇ ਨੌ ਵਜੇ ਤੱਕ ਇੱਥੇ ਹੀ ਹੁੰਦੇ ਹਾਂ ਅਸੀਂ ਦੁਕਾਨ 'ਤੇ ਹਾਂਜੀ ਹਾਂਜੀ ਹਾਂਜੀ ਘਰੇ ਉਹ ਮੁੰਡਾ ਛੱਡ ਆਏਗਾ ਅੱਠ ਤੋਂ ਸਾਢੇ ਨੌ ਉਹ ਜੀ ਅੱਠ ਤੋਂ ਅੱਠ ਹੈ ਜੀ ਹੌਮ ਡਿਲੀਵਰੀ ਜੀ ਹਾਂਜੀ ਹਾਂਜੀ ਜੀ ਤੁਸੀਂ ਇਸੇ ਨੰਬਰ 'ਤੇ ਭੇਜ ਦਿਓ ਚਾਹੇ ਵੱਟਸਅੱਪ ਕਰ ਦਿਓ ਚਾਹੇ ਲਿਸਟ ਬਣਾ ਕੇ ਫੋਟੋ ਖਿੱਚ ਕੇ ਭੇਜ ਦਿਓ ਅਤੇ ਅਸੀਂ ਕਰਾਂ ਦਵਾਂਗੇ ਹਾਂਜੀ ਇਹ ਹੀ ਹਾਂਜੀ ਹਾਂਜੀ ਹਾਂਜੀ ਬਾਕੀ ਕੁਆਲਟੀ ਦੀ ਚਿੰਤਾਂ ਨਾ ਕਰਿਓ ਕੁਆਲਟੀ ਬਹੁਤ ਵਧੀਆ ਹੈ ਸਾਡੀ ਸਬਜ਼ੀ ਦੀ ਤੁਸੀਂ ਇੱਕ ਵਾਰੀ ਚੈੱਕ ਕਰਕੇ ਦੇਖਿਓ ਤਾਹੀ ਤੁਹਾਨੂੰ ਗੁਆਂਢੀਆਂ ਨੇ ਵੀ ਸਾਡਾ ਨੰਬਰ ਦਿੱਤਾ ਹੋਣਾ ਹੈ ਠੀਕ ਹੈ ਜੀ ਦੱਸ ਦਿਓ ਜਦ ਵੀ ਡਿਲੀਵਰ ਕਰਨਾ ਹੋਇਆ ਮੈਨੂੰ ਮੈਸਿਜ ਕਰ ਦਿਓ ਠੀਕ ਹੈ ਜੀ ਓਕੇ